ਤਿਲਕਣ ਭਰੇ ਪਹਾੜ ਉੱਤੇ ਚੜਨ ਵੇਲੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਨਾਂ ਵਿੱਚ ਸਾਡੇ ਬੂਟ ਬਹੁਤ ਇਹ ਵਧੀਆ ਹੋਣੇ ਚਾਹੀਦੇ ਹਨ ਤਾਂ ਜੋ ਸਾਡੇ ਪੈਰ ਮਿੱਟੀ ਵਿੱਚ ਫਿਸਲਣ ਨਾ ਨਾਲ ਹੀ ਸਾਡੇ ਕੋਲ ਰੇਨ ਕੋਟ ਬਰਸਾਤੀਆਂ ਵਗੈਰਾ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਨਾਲ ਨਾਲ ਪਹਾੜ ਲਈ ਸਮਾਨ ਜਿਵੇਂ ਕਿ ਰੱਸਾ ਚਾਕੂ ਇਹ ਹੋਣਾ ਜਰੂਰੀ ਹੈ ਇਸ ਦੇ ਨਾਲ ਨਾਲ ਜੰਗਲੀ ਜਾਨਵਰ ਤੋਂ ਬਚਣ ਲਈ ਕੁਝ ਡੰਡੇ ਵਗੈਰਾ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਪਹਾੜ ਉੱਤੇ ਰੋਕ ਲਾਈਵੇ ਸਹੀ ਢੰਗ ਨਾਲ ਤੇ ਸੇਫ ਤਰੀਕੇ ਨਾਲ ਕਰ ਸਕੀਏ